ਹੁਣ ਲੋਕ ਘਰ ਬੈਠੇ ਹੀ ਪਹਿਲਾਂ ਹੀ ਕਿਤੇ ਜਾਣ ਤੋਂ ਪਹਿਲਾਂ ਹੀ ਹੋਟਲ ਬੁੱਕ ਕਰਵਾ ਦੇ ਨੇ ਜਿਵੇਂ ਦੀ ਉਹਨਾਂ ਨੂੰ ਫੈਸਿਲਿਟੀ ਚਾਹੀਦੀ ਆ ਉਹ ਉਦਾਂ ਦੀ ਫੈਸਿਲਿਟੀ ਆ ਉਹ ਪਹਿਲਾਂ ਹੀ ਬੁੱਕ ਕਰਵਾ ਦਿੰਦੇ ਹਨ ਸੋ ਬੇਸਿਕਲੀ ਜਿਹੜੀ ਟੈਕਨੋਲੋਜੀ ਆ ਟੈਕਨੋਲੋਜੀ ਨੇ ਜਿਹੜਾ ਟਰੈਵਲ ਆ ਉਹ ਬਹੁਤ ਜ਼ਿਆਦਾ ਈਜ਼ੀ ਕਰ ਦਿੱਤਾ ਅਤੇ ਲੋਕ ਪਹਿਲਾਂ ਹੀ ਦੇਖ ਲੈਂਦੇ ਹਨ ਕਿਹੜੀ ਥਾਂ ਦੇ ਉੱਪਰ ਕਿਹੜੀ ਟੂਰਿਜ਼ਮ ਪਲੇਸ ਦੇ ਉੱਪਰ ਕਿਹੜੀ ਚੀਜ਼ ਘੁੰਮਣ ਵਾਲੀ ਉਥੇ ਕਿੰਨਾ ਚੀਜ਼ ਸਟੇਅ ਕਰਨੀ ਹੈ ਕਿੰਨੇ ਟਾਈਮ ਦੇ ਲਈ ਹੋਟਲ ਲੈਣਾ ਸੋ ਇਹ ਚੀਜ਼ ਟੈਕਨੋਲੋਜੀ ਬਹੁਤ ਹੈਲਪਫੁਲ ਹੈ